ਬੁਣਾਈ ਮੇਰੇ ਲਈ ਇੱਕ ਰੁਝਾਨ ਹੈ ਅਸੀਂ ਜਦੋਂ ਵੀ ਚਾਹੋ ਅਸੀਂ ਆਪਣੇ ਬੁਣਾਈ ਸਵੈਟਰ ਜਾਂ ਬੱਚੇ ਦਾ ਕੁਝ ਬਣਾਉਣਾ ਹੋਵੇ ਅਸੀਂ ਖੁਦ ਜਲਦੀ ਤੋਂ ਜਲਦੀ ਬਣਾ ਸਕਦੇ ਹਾਂ ਇਹ ਇੱਕ ਕਮਾਈ ਦਾ ਸਾਧਨ ਵੀ ਹੈ ਜਦੋਂ ਤੁਹਾਨੂੰ ਜ਼ਰੂਰਤ ਪਵੇ ਤੁਸੀਂ ਇਹਨੂੰ ਦੂਸਰਿਆਂ ਦਾ ਕੰਮ ਕਰਕੇ ਦੂਸਰਿਆਂ ਦੀ ਬੁਣਾਈ ਦਾ ਕਰਕੇ ਇਹਦੇ ਨਾਲ ਕਮਾਈ ਕਰ ਸਕਦੇ ਹਾਂ